ਕੁਛ ਦਿਨ ਪਹਿਲਾਂ ਮੇਰੇ ਦਾਦਾ ਜੀ ਦੀ ਡੈਥ ਹੋਈ ਅਤੇ ਵਿੱਤੀ ਮਾਮਲਿਆਂ ਨੂੰ ਸੁਲਝਾਉਣ ਲਈ ਮੈਂ ਅਤੇ ਜਾਇਦਾਦ ਦੇ ਮਾਮਲਿਆਂ ਨੂੰ ਹੀ ਸੰਭਾਲਣ ਲਈ ਮੈਨੂੰ ਉਹਨਾਂ ਦੇ ਮੌਤ ਸਰਟੀਫਿਕੇਟ ਦੀ ਜ਼ਰੂਰਤ ਸੀ ਇਸ ਲਈ ਮੈਂ ਸੁਵਿਧਾ ਕੇਂਦਰ ਗਈ ਫਿਰ ਉੱਥੇ ਮੈਨੂੰ ਸੁਵਿਧਾ ਕੇਂਦਰ ਵਿੱਚ ਦੱਸਿਆ ਗਿਆ ਕਿ ਤੁਸੀਂ ਇਹ ਇਹ ਆਪਦਾ ਵੇਰਵਾ ਲੈ ਕੇ ਆਓ ਜਿਵੇਂ ਕਿ ਮੇਰੇ ਦਾਦਾ ਜੀ ਦਾ ਆਧਾਰ ਕਾਰਡ ਮੇਰੇ ਦਾਦਾ ਜੀ ਦੇ ਅੱਗੋਂ ਦੋ ਬੇਟੇ ਅਤੇ ਇੱਕ ਬੇਟੀ ਸਨ ਫਿਰ ਮੈਂ ਆਪਣੇ ਦਾਦਾ ਦਾਦਾ ਜੀ ਦੇ ਦੋ ਬੇਟਿਆਂ ਦੇ ਸਰਟੀਫਿਕੇਟ ਆਧਾਰ ਕਾਰਡ ਜਨਮ ਸ ਜਨਮ ਦਾ ਸਰਟੀਫਿਕੇਟ ਉਹਨਾਂ ਦੀ ਬੇਟੀ ਦਾ ਵੀ ਜਨਮ ਸਰਟੀਫਿਕੇਟ ਅਤੇ ਆਧਾਰ ਕਾਰਡ ਲੈ ਕੇ ਗਈ ਫਿਰ ਉੱਥੇ ਉਹਨਾਂ ਨੇ ਦਾਦ ਦਾਦੀ ਜੀ ਦਾ ਵੀ ਆਧਾਰ ਕਾਰਡ ਮੰਗਿਆ ਫਿਰ ਮੈਂ ਉਹ ਵੀ ਆਧਾ ਆਧਾਰ ਕਾਰਡ ਵੀ ਉੱਥੇ ਜਮ੍ਹਾਂ ਕਰਵਾਇਆ ਜਿਸ ਨਾਲ ਫਿਰ ਉਹਨਾਂ ਨੇ ਆਨਲਾਈਨ ਕੋਈ ਆਪਦੀ ਪ੍ਰਕਿਰਿਆ ਕੀਤੀ ਜਿਸ ਵਿੱਚ ਉਹਨਾਂ ਨੇ ਸਾਰਾ ਵੇਰਵਾ ਲਿਖਿਆ ਜੋ ਕਿ ਮੇਰੇ ਦਾਦਾ ਜੀ ਦੇ ਦੋ ਬੱਚਿਆਂ ਦਾ ਦੋ ਬੇਟਿਆਂ ਦਾ ਅਤੇ ਇੱਕ ਬੇ ਬੇਟੀ ਦਾ ਵੇਰਵਾ ਸਾਰਾ ਆਧਾਰ ਕਾਰਡ ਜਨਮ ਸਰਟੀਫਿਕੇਟ ਅਤੇ ਮੇਰੇ ਦਾਦੀ ਜੀ ਦਾ ਆਧਾਰ ਕਾਰਡ ਲਗਾਇਆ ਅਤੇ ਉਹਨਾਂ ਨੇ ਆਨਲਾਈਨ ਫੋਰਮ ਭਰਿਆ ਜਿਸ ਨਾਲ ਮੈਨੂੰ ਮੌਤ ਸਰਟੀਫਿਕੇਟ ਪ੍ਰਾਪਤ ਹੋਇਆ ਜਿਸ ਨਾਲ ਮੈਂ ਹੁਣ ਆਪਦੇ ਉਹਨਾਂ ਦੇ ਵਿੱਤੀ ਮਾਮਲੇ ਅਤੇ ਜਾਇਦਾਦ ਦੇ ਵੱਖਰੇ ਵੱਖਰੇ ਮਾਮਲਿਆਂ ਨੂੰ ਸੁਲਝਾਉਣ ਵਿੱਚ ਕਾਮਯਾਬ ਹੋ ਜਾਵਾਂਗੀ ਕਿਉਂਕਿ ਮੈਨੂੰ ਹੁਣ ਉਹਨਾਂ ਦਾ ਮੌਤ ਸਰਟੀਫਿਕੇਟ ਮਿਲ ਚੁੱਕਿਆ ਹੈ